ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਕੀ ਹਾਲ ਹੈ ਵਾ ਵਧੀਆ ਜੀ ਵਧੀਆ ਹੋਰ ਦ ਦੱਸੋ ਕੀ ਚੱਲਦਾ ਅੱਛਾ ਅੱਛਾ ਸਾਡੀ ਤਾਂ ਐਤਕੀ ਫਸਲ ਹੀ ਮੀਂਹ ਨੇ ਬੜੀ ਖਰਾਬ ਕਰਤੀ ਹੈ ਜੀ ਬੜਾ ਹਾਂ ਉਹਦੇ ਕਰਕੇ ਸਾਡ ਉਹਦੇ ਕਰਕੇ ਫਿਰ ਐਤਕੀ ਕੁੜੀ ਦਾ ਵੀ ਕਰਵਾਉਣਾ ਸੀਗਾ ਉਹ ਵੀ ਰਹਿ ਗਿਆ ਵਿੱਚੇ ਹੁਣ ਰੋਕਿਆ ਹੋਇਆ ਪਤਾ ਨਹੀਂ ਹੁਣ ਕੀ ਸਮਝ ਨਹੀਂ ਆ ਰਿਹਾ ਕੀ ਕਰੀਏ ਕੀ ਨਹੀਂ ਹੋਰ ਕਰਜ਼ਾ ਤਾਂ ਕ ਜੇ ਕਰਜ਼ਾ ਲਾਵਾਂਗੇ ਤਾਂ ਕਰਜ਼ੇ 'ਚ ਹੀ ਫਸ ਜਾਵਾਂਗੇ ਹੋਰ ਜੀ ਕੁਛ ਸਮਝ ਨਹੀਂ ਆ ਰਿਹਾ ਕੀ ਕਰੀਏ ਕੀ ਨਹੀਂ ਸਾਰਾ ਕੰਮ ਉਲਝਿਆ ਹੋਇਆ

ਹੂੰ ਹੂੰ

ਹੂੰ ਹੂੰ ਹੂੰ ਐ ਹੂੰ ਬੜਾ ਉਲਝ ਮੌਸਮ ਦਾ ਕੁਛ ਨਹੀਂ ਪਤਾ ਲੱਗਿਆ ਜੀ ਮੌਸਮ ਨੇ ਬੜਾ ਕੰਮ ਖਰਾਬ ਕਰਿਆ ਆਪਣਾ ਐਤਕੀ

ਹੂੰ ਸਰ ਰੇਟ ਹੀ ਸਾਰਾ ਟੁੱਟਿਆ ਹੋਇਆ ਮਿਲਦਾ ਰੇਟ ਹੀ ਸਾਰਾ ਟੁੱਟ ਹੁਣ ਭਾਅ ਜੀ ਹੁਣ ਸਾਰੇ ਹੱਥ ਕੰਨਾਂ ਨੂੰ ਹੱਥ ਖੜੇ ਨੇ ਆਪਣੇ ਲੱਗ ਚੁੱਕੇ ਲੱਗ ਚੁੱਕੇ ਆ ਆਪਣੇ ਕੰਨਾਂ ਨੂੰ ਹੱਥ ਜੀ ਕੀ ਹੁਣ ਕੋਈ ਇਲਾਜ ਹੀ ਨਹੀਂ ਹੁਣ ਦੱਸੋ ਕੀ ਕਰੀਏ ਕੀ ਨਹੀਂ ਕੁਛ ਪੱਲੇ ਹੀ ਨਹੀਂ ਪੈ ਰਿਹਾ ਉਹ ਵਿਆਹ ਕਰਨ ਵਿਆਹ ਕਰਨਾ ਸੀ ਹੁਣ ਸਾਰੀ ਤਿਆਰੀ ਚੱਲ ਰਹੀ ਸੀਗੀ ਵਿਆਹ ਦੀ ਹੁਣ ਆ ਇੱਧਰ ਨਾ ਇੰਨਾ ਕੁਛ ਹੋ ਗਿਆ ਇਸ ਕਰਕੇ ਫਿਰ ਦਿੱਕਤ ਬੜੀ ਆ ਰਹੀ ਆ ਹੁਣ ਕਹਿ ਹੁਣ ਹੁਣ ਵਿਆਹ ਹੁਣ ਜ਼ਿਆਦਾ ਟਾਈਮ ਰੋਕ ਵੀ ਨਹੀਂ ਸਕਦੇ ਕਰਜ਼ਾ ਲੈਣਾ ਪੈਣਾ ਕਰਜ਼ਾ ਈ ਲੈਣਾ ਪੈਣਾ ਕਰਜ਼ਾ ਲੈ ਕੇ ਫਿਰ ਕੁੜੀ ਤੋਰਾਂਗੇ ਜੀ ਫਿਰ ਹੌਲੀ ਹੌਲੀ ਕਰਜ਼ਾ ਉਤਰੂਗਾ ਬਸ ਦੇਖਦੇ ਆ ਜੀ ਹੁਣ ਪਤਾ ਨਹੀਂ ਐਤਕੀ ਕੈਸੀ ਨਿਕਲੂਗੀ ਫਸਲ ਹੂੰ ਦੇਖਦੇ ਆ ਹੁਣ ਹੋਰ ਤੁਸੀਂ ਦੱਸੋ ਤੁਹਾਡਾ ਕਿਵੇਂ ਚੱਲਦਾ ਉਹ ਤਾਂ ਹੈ ਜੀ ਇਹ ਤਾਂ ਇਹ ਇਹਨਾਂ ਦਾ ਅੱਡ ਖਰਚਾ ਮਾਣ ਨਹੀਂ ਆਉਂਦਾ ਮਿੰਟ ਬਾਅਦ ਤਾਂ ਕੁਛ ਨਾ ਕੁਛ ਭਾ ਭਾਲਦੇ ਰਹਿੰਦੇ ਨੇ ਇਹ ਵੀ ਹਾਂ ਹੋਰ ਇਹਨਾਂ ਆਪਣੇ ਜਵਾਕਾ ਦੇ ਘੱਟ ਨਖਰੇ ਨੇ ਇਹਨਾਂ ਦੇ ਵੱਧ ਨਖਰੇ ਆ ਚਲੋ ਕੋਈ ਗੱਲ ਨਹੀਂ ਜੀ ਮੈਂ ਤੁਹਾਨੂੰ ਠਹਿਰ ਕੇ ਕਰਦਾ ਕੋਲ ਮੇਰੀ ਬੁਲਾ ਰਹੇ ਨੇ ਇੱਧਰ ਮੈਨੂੰ ਠੀਕ ਹੈ ਜੀ ਓਕੇ ਸਤਿ ਸ਼੍ਰੀ ਅਕਾਲ